ਨਮਸਕਾਰ ਜੀ ਅਸੀਂ ਗੁਰਦਾਸਪੁਰ ਦੇ ਰਹਿਣ ਵਾਲੇ ਹਾਂ ਮੈਨੂੰ ਤਾਂ ਵੈਸੇ ਜਾਨਵਰਾਂ ਨਾਲ ਖ਼ਾਸ ਹੀ ਰਿਸ਼ਤਾ ਆ ਕਿਉਂਕਿ ਮੈਂ ਉਹਨਾਂ ਨੂੰ ਜਾਨਵਰਾਂ ਨੂੰ ਕਾਫ਼ੀ ਪਿਆਰ ਕਰਦੀ ਰਹੀ ਹਾਂ ਆਪਾਂ ਸ਼ੁਰੂ ਦੇ ਵਿੱਚ ਡੰਗਰ ਰੱਖਦੇ ਰਹੇ ਹਾਂ ਸਾਡੇ ਪੇਰੈਂਟਸ ਰੱਖਦੇ ਰਹੇ ਉਹਨਾਂ ਨਾਲ ਅਸੀਂ ਲਗਾਅ ਪੂਰਾ ਕਰੀਦਾ ਸੀਗਾ ਜਦੋਂ ਸਾਨੂੰ ਵੈਸੇ ਅਸੀਂ ਛੋਟੇ ਛੋਟੇ ਹੁੰਦੇ ਸਾਨੂੰ ਇਹ ਵੀ ਸ਼ੌਂਕ ਹੁੰਦਾ ਅਸੀਂ ਗਾਈਆਂ ਮੱਝਾਂ ਜਦੋਂ ਕੋਲ ਆ ਜਾਂਦੀਆਂ ਨਾ ਉਹਨਾਂ ਦੇ ਅਪ ਵੈਸੇ ਹੀ ਉੱਥੇ ਹੱਥ ਫੇਰਦੇ ਰਹਿਣਾ ਜਾਂ ਉਹਨਾਂ ਦੀਆਂ ਕਦੇ ਕਈ ਵਾਰ ਪੂਛ ਨੂੰ ਟੱਚ ਕਰਕੇ ਆਉਣਾ ਫਿਰ ਅਸੀਂ ਖੁਦ ਨਹਾਉਣਾ ਵੀ ਨਹਾਈ ਦਾ ਵੀ ਹੁੰਦਾ ਸੀ ਪੈਪ ਲਗਾਉਣੀ ਨਹਾ ਦੇਣਾ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਚੰਗੀ ਤਰਾਂ ਬ੍ਰਸ਼ ਮਾਰ ਮਾਰ ਕੇ ਨਹਾਉਣਾ ਕਈ ਵਾਰ ਆਪਾਂ ਨਾ ਇਹਨਾਂ ਦੇ ਉਹ ਜਿਹੜਾ ਮੱਥਾ ਹੁੰਦਾ ਸੀ ਨਾ ਵਾਈਟ ਰੰਗ ਦਾ ਹੋਣਾ ਅਤੇ ਉੱਤੇ ਮਹਿੰਦੀ ਲਗਾਉਣੀ ਪਾਪਾ ਅਸੀਂ ਮਹਿੰਦੀ ਲਗਾਉਣੀ ਤਾਂ ਉਨ੍ਹਾਂ ਨੇ ਕਹਿਣਾ ਕੋਈ ਗੱਲ ਨਹੀਂ ਲਗਾਓ ਅਤੇ ਸਾਨੂੰ ਸੋਹਣੇ ਲੱਗਦੇ ਸੀਗੇ ਅਸੀਂ ਜਾਨਵਰਾਂ ਦੀ ਵੀ ਮਤਲਬ ਅੱਛੀ ਤਰ੍ਹਾਂ ਅਸੀਂ ਮਤਲਬ ਦੇਖਭਾਲ ਕਰਦੇ ਹੁੰਦੇ ਸੀਗੇ ਅਤੇ ਉਹਨਾਂ ਦੇ ਨਾਲ ਫਿਰ ਸਾਡਾ ਉਹਨਾਂ ਦਾ ਪਿਆਰ ਬਣ ਜਾਂਦਾ ਸੀ ਜਿੱਦਾਂ ਅਸੀਂ ਜਾਣਾ ਉਹਨਾਂ ਨੇ ਸਾਨੂੰ ਨਾ ਆਵਾਜ਼ ਦੇਣੀ ਕਿ ਸਾਨੂੰ ਪੱਠਾ ਦਿਓ ਉਹਨਾਂ ਨੇ ਮੈਂ ਕਰਨਾ ਆਪਾਂ ਫਿਰ ਚਲ ਜਾਣਾ ਪੱਠੇ ਲੈਣੇ ਆ ਜਾਂ ਇਹਨਾਂ ਨੇ ਪਾਣੀ ਪੀਣਾ ਵਾ ਗਊਆਂ ਦਾ ਇਹ ਹੁੰਦਾ ਸੀਗਾ ਅਤੇ ਜਦੋਂ ਆਪਾਂ ਉਹਨਾਂ ਦੇ ਲਾਗੋਂ ਦੀ ਲੰਘਣਾ ਹਵੇਲੀ ਤੋਂ ਲੰਘਣਾ ਇਹਨਾਂ ਨੇ ਹਵੇਲੀ ਬੰਨੀਆ ਹੁੰਦਾ ਸੀ ਅਤੇ ਜਦੋਂ ਆਪਾਂ ਹਵੇਲੀ ਜਾਣਾ ਉਹਨਾਂ ਨੂੰ ਧੁੱਪੇ ਕਰਨ ਜਾਣਾ ਸ਼ਾਮੇਂ ਕਰਨ ਜਾਣਾ ਕਿਉਂਕਿ ਉਹਨਾਂ ਦੇ ਪਰੇ ਤੇ ਤੁਹਾਨੂੰ ਲਗਾਅ ਸੀਗਾ ਕਿਉਂਕਿ ਆਪਾਂ ਇੱਦਾ ਥੋੜ੍ਹੇ ਰਹਿਣ ਦਿੰਦੇ ਹਾਂ ਕਿਉਂਕਿ ਬਈ ਕੋਈ ਵੀ ਹੈ ਜਾਨਵਰ ਉਹਨੂੰ ਆਪਣਾ ਬਣਾ ਲਈ ਦਾ ਬਿਲਕੁਲ ਕਿਉਂਕਿ ਉਹਨੂੰ ਵੀ ਧੁੱਪ ਲੱਗਦੀ ਹੈ ਇਨਸਾਨ ਦੀ ਤਰ੍ਹਾਂ ਹੀ ਹੈ ਧੁੱਪ ਲੱਗੇਗੀ ਫਿਰ ਸਾਨੂੰ ਇਹ ਵੀ ਮਨ 'ਚ ਹੁੰਦਾ ਕਿ ਉਹਨੂੰ ਧੁੱਪ ਲੱਗੀ ਹੈ ਆਪਾਂ ਉਹਨਾਂ ਨੂੰ ਸ਼ਾਮੇਂ ਬੰਨਣ ਜਾਣਾ ਹੈ ਫਿਰ ਉਹ ਸਾਡੇ ਵੱਲ ਵੇਖਦੇ ਆ ਕਈ ਵਾਰ ਜੀਭ ਮਾਰਦੇ ਹੁੰਦੇ ਸੀ ਕਈ ਵਾਰ ਆਪਾਂ ਧਾਰ ਕੱਢਣ ਜਾਣਾ ਨਾ ਅਤੇ ਇਹਨਾਂ ਨੇ ਨਾ ਮਤਲਬ ਜੀਭਾਂ ਨਾਲ ਚੱਟਦੀ ਹੁੰਦੀਆਂ ਸੀ ਅਤੇ ਇੱਦਾਂ ਇਨਸਾਨ ਨੂੰ ਚੱਟਣ ਲੱਗ ਪੈਣਾ ਉਹਨਾਂ ਨੇ ਕਿਉਂਕਿ ਉਹ ਪਿਆਰ ਕਰਦੇ ਸੀਗੇ ਆਪਾਂ ਵੀ ਉਹਨਾਂ ਦੇ ਰਿਲੇਟਿਡ ਬੱਚੇ ਨੂੰ ਵਾਂਗੂ ਹੀ ਰੱਖਣਾ ਪੈਂਦਾ ਸੀਗਾ ਡੰਗਰਾਂ ਨਾਲ ਵੀ ਅੱਛਾ ਪਿਆਰ ਹੀ ਕਰਨਾ ਚਾਹੀਦਾ ਹੈ ਕਿਉਂ ਉਹ ਆਪਾਂ ਤਾਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਰਹੇ ਹਾਂ